ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਤਨਾਮ ਸਿੰਘ ਜੀ ਬੋਲ ਰਹੇ ਹੋ ਹਾਂਜੀ ਸਰ ਮੈਂ ਬਬੀਤਾ ਅਰੌੜਾ ਬੋਲ ਰਹੀ ਹਾਂ ਜੀ ਕਬੀਰ ਪਾਰਕ ਤੋਂ ਮੈਂ ਓਲਾ ਬੁੱਕ ਕਰਵਾਈ ਸੀ ਜੀ ਇੱਥੇ ਕਬੀਰ ਪਾਰਕ ਤੋਂ ਆਉਣ ਲਈ ਹਾਂਜੀ ਮੇਰੇ ਕੋਲ ਤੁਹਾਡਾ ਨੰਬਰ ਆਇਆ ਜੀ ਅਤੇ ਸਰ ਇੱਦਾਂ ਸੀਗਾ ਕਿ ਅਸੀਂ ਥੋੜ੍ਹੀ ਜਲਦੀ 'ਚ ਸੀਗੇ ਅਤੇ ਅਸੀਂ ਨਾ ਇੱਥੋਂ ਅਸੀਂ ਨਿਕਲ ਪਏ ਹਾਂ ਅਤੇ ਤੁਸੀਂ ਮੈਨੂੰ ਪੁਤਲੀ ਘਰ ਚੌਂਕ ਤੋਂ ਪਿਕਅੱਪ ਕਰ ਸਕਦੇ ਜੇ ਕਿਉਂਕਿ ਅਸੀਂ ਜਾਣਾ ਤਾਂ ਉੱਥੇ ਹੀ ਹੈ ਮਜੀਠਾ ਬਾਈਪਾਸ 'ਤੇ ਜਿਹੜਾ ਰਿਜ਼ੋਰਟ ਹੈ ਮਹਾਰਾਜਾ ਅਤੇ ਪਰ ਅਸੀਂ ਨਿਕਲ ਪਏ ਥੋੜ੍ਹਾ ਜਿਹਾ ਕੋਈ ਕੰਮ ਸੀ ਮੈਨੂੰ ਅਤੇ ਮੈਂ ਉਹਦੇ ਕਰਕੇ ਜਲਦੀ ਨਿਕਲ ਆਈ ਸੀ ਅਗਰ ਤੁਸੀਂ ਮੈਨੂੰ ਪੁਤਲੀ ਘਰ ਤੋਂ ਪਿਕਅੱਪ ਕਰ ਲਓ ਅਤੇ ਉੱਥੇ ਮੈਨੂੰ ਡਰੋਪ ਕਰ ਦਿਓ ਪੇਮੈਂਟ ਦੀ ਕੋਈ ਪ੍ਰੋਬਲਮ ਨਹੀਂ ਉਹ ਮੈਂ ਤੁਹਾਨੂੰ ਔਨਲਾਈਨ ਹੀ ਕਰਾਂਗੀ ਅਤੇ ਪਰ ਮੈਨੂੰ ਆਉਣਾ ਪੈ ਗਿਆ ਤੁਸੀਂ ਮੈਨੂੰ ਉੱਥੇ ਪੁਤਲੀ ਘਰ ਚੌਂਕ 'ਚ ਪਹੁੰਚ ਕੇ ਮੈਨੂੰ ਕੌਲ ਕਰ ਲਓ ਇਸ ਨੰਬਰ 'ਤੇ ਜਿਸ ਨੰਬਰ 'ਤੇ ਮੈਂ ਤੁਹਾਨੂੰ ਕੌਲ ਕਰ ਰਹੀ ਆਂ ਤੁਸੀਂ ਮੈਨੂੰ ਕੌਲ ਕਰ ਲਓ ਅਤੇ ਮੈਂ ਤੁਹਾਨੂੰ ਇੱਕ ਡੈਸਟੀਨੇਸ਼ਨ ਦੇ ਦਾਂਗੀ ਉੱਥੇ ਖੜੇ ਹੋ ਜਾਣਾ ਮੈਂ ਉੱਥੋਂ ਤੁਹਾਨੂੰ ਲੈ ਲਾਂਗੀ ਜੀ ਠੀਕ ਹੈ ਸਰ ਥੈਂਕ ਯੂ ਜੀ